ਜੇਕਰ ਅਸੀਂ ਆਪਣੀ ਸਰੀਰਿਕ ਅਤੇ ਮਾਨਸਿਕ ਸਿਹਤ ਨੂੰ ਧਾਰਮਿਕ ਦ੍ਰਿਸ਼ਟੀਕੋਣ ਨਾਲ ਜੋੜ ਕੇ ਦੇਖੀਏ ਤਾਂ ਵੱਖ ਵੱਖ ਧਰਮ ਬੰਦੇ ਦੀ ਜ਼ਿੰਦਗੀ ਬਾਰੇ ਉਹਨੂੰ ਕਿਵੇਂ ਚੰਗਾ ਰੱਖਣਾ ਹੈ ਅਤੇ ਆਪਣੇ ਸਰੀਰਿਕ ਸਿਹਤ ਨੂੰ ਅਤੇ ਮਾਨਸਿਕ ਸਿਹਤ ਨੂੰ ਕਿਵੇਂ ਤੰਦਰੁਸਤ ਰੱਖਣਾ ਹੈ ਇਸ ਬਾਰੇ ਬਹੁਤ ਚੰਗੇ ਤਰੀਕੇ ਦੇ ਨਾਲ ਡੇਲੀ ਰੂਟੀਨ ਦੇ ਵਿੱਚ ਬੜੇ ਚੰਗੇ ਸੁਝਾਅ ਦਿੰਦੇ ਹਨ ਕੋਈ ਵੀ ਧਰਮ ਦੀ ਗੱਲ ਕਰੀਏ ਚਾਹੇ ਉਹ ਸਿੱਖ ਧਰਮ ਹੋਵੇ ਜਾਂ ਹਿੰਦੂ ਧਰਮ ਹੋਵੇ ਜਾਂ ਮੁਸਲਮਾਨ ਧਰਮ ਹੋਵੇ ਇਹਨਾਂ ਧਰਮਾਂ ਦੇ ਵਿੱਚ ਮੁੱਖ ਤੌਰ 'ਤੇ ਇਹੀ ਕਿਹਾ ਜਾਂਦਾ ਹੈ ਕਿ ਸਵੇਰੇ ਟਾਈਮ ਦੇ ਨਾਲ ਅੰਮ੍ਰਿਤ ਵੇਲੇ ਬੰਦੇ ਨੂੰ ਉੱਠਣਾ ਚਾਹੀਦਾ ਹੈ ਉੱਠ ਕੇ ਇਸ਼ਨਾਨ ਕਰਕੇ ਆਪਣੇ ਸਰੀਰ ਦੀ ਸਫਾਈ ਕਰਕੇ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਸਰੀਰ ਦੀ ਸਫਾਈ ਦੇ ਨਾਲ ਤੁਹਾਡੀ ਸਰੀਰਿਕ ਸਿਹਤ ਨਰੋਗ ਰਹਿੰਦੀ ਹੈ ਅਤੇ ਸਵੇਰੇ ਉੱਠ ਕੇ ਜੋ ਪਾਠ ਕਰਨਾ ਹੈ ਜਾਂ ਆਪਣੀ ਪੂਜਾ ਕਰਨੀ ਹੈ ਭਗਤੀ ਕਰਨੀ ਹੈ ਉਹਦੇ ਨਾਲ ਮਾਨਸਿਕ ਤੰਦਰੁਸਤੀ ਵੱਲ ਵੀ ਬੰਦੇ ਦਾ ਮ ਮਾਨਸਿਕ ਤੰਦਰੁਸਤੀ ਵਿੱਚ ਵੀ ਬੰਦਾ ਅਰੋਗ ਰਹਿੰਦਾ ਹੈ ਅਤੇ ਇਸ ਤਰ੍ਹਾਂ ਬੰਦੇ ਨੂੰ ਬੰਦੇ ਦੇ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ ਇਸ ਤੋਂ ਇਲਾਵਾ ਵੱਖ ਵੱਖ ਧਰਮਾਂ ਦੇ ਵਿੱਚ ਜਿਵੇਂ ਕਿ ਯੋਗਾ ਨੂੰ ਵੀ ਬੜੀ ਮ ਮਹੱਤਤਾ ਦਿੱਤੀ ਗਈ ਹੈ ਅਤੇ ਯੋਗਾ ਦੇ ਨਾਲ ਵੀ ਸਰੀਰਿਕ ਅਤੇ ਮਾਨਸਿਕ ਦੋਨੋਂ ਤਰ੍ਹਾਂ ਦੀ ਤੰਦਰੁਸਤੀ ਪ੍ਰਾਪਤ ਕੀਤੀ ਜਾ ਸਕਦੀ ਹੈ